ਹਰਿਆ ਭਰਿਆ ਅਤੇ ਸਾਫ਼ ਵਾਤਾਵਰਨ ਦੀ ਰੱਖਿਆ ਕਰਨ ਲਈ ਸਾਨੂੰ ਰੋਜ਼ ਦਾ ਇੱਕ ਬੂਟਾ ਲਗਾਉਣਾ ਚਾਹੀਦਾ ਹੈ ਅਤੇ ਬੂਟਿਆਂ ਦੀ ਕਟਾਈ ਘੱਟ ਕਰਨੀ ਚਾਹੀਦੀ ਹੈ ਹਰ ਰੋਜ਼ ਇੱਕ ਬੂਟਾ ਲਗਾ ਕੇ ਉਸਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਇਸਦੇ ਨਾਲ ਸਾਡਾ ਵਾਤਾਵਰਨ ਸਾਫ਼ ਅਤੇ ਸੁਥਰਾ ਰਹੇਗਾ ਅਤੇ ਸਾਨੂੰ ਆਸ ਲਾਗੇ ਸ਼ਾਗੇ ਸਾਰੇ ਕਿਤੇ ਕਾਗਜ਼ ਕੁਗਜ਼ ਚੁੱਕ ਕੇ ਸਫ਼ਾਈ ਕਰ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਾਗਜ਼ਾਂ ਨੂੰ ਡਸਟਬਿਨ ਦੇ ਵਿੱਚ ਪਾਉਣਾ ਚਾਹੀਦਾ ਹੈ ਅਤੇ ਕਿਤੇ ਵੀ ਪਾਣੀ ਅਤੇ ਗੰਦਾ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਹੈ ਜਿਸ ਨਾਲ ਮੱਛਰ ਪੈਦਾ ਹੁੰਦਾ ਹੈ ਵਾਤਾਵਰਨ ਸਾਫ਼ ਰਹੇਗਾ ਤਾਂ ਸਾਡਾ ਸਵੱਸਥ ਵੀ ਸਾਫ਼ ਰਹੇਗਾ ਇਸ ਨਾਲ ਸਵੇਰੇ ਅਤੇ ਸ਼ਾਮੀ ਤਾਜ਼ੀ ਹਵਾ ਲਵਾਂਗੇ ਤਾਂ ਸਾਡਾ ਸਾਡੀ ਸਿਹਤ ਬਹੁਤ ਚੰਗੀ ਰਹੇਗੀ ਸਿਆਣੇ ਬੰਦੇ ਨੂੰ ਵੀ ਤਾਜ਼ੀ ਹਵਾ ਦਿਵਾਉਣੀ ਚਾਹੀਦੀ ਹੈ ਤਾਂ ਜੋ ਉਸਦੀ ਸਿਹਤ ਚੰਗੀ ਰਹੇ ਵਾਤਾਵਰਨ ਨੂੰ ਚੰਗਾ ਕਰਨ ਲਈ ਸਾਡੀ ਆਪਣੀ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਆਪਾਂ ਰੋਜ਼ ਦੇ ਬੂਟੇ ਨੂੰ ਪਾਣੀ ਦੇਵਾਂਗੇ ਤਾਂ ਬੂਟੇ ਵੱਡੇ ਵੱਡੇ ਹੋਣਗੇ ਅਤੇ ਸਾਨੂੰ ਤਾਜ਼ੀ ਤਾਜ਼ੀ ਹਵਾ ਮਿਲੇਗੀ ਇਸ ਲਈ ਸਾਨੂੰ ਬੂਟਿਆਂ ਨੂੰ ਕੱਟਣਾ ਨਹੀਂ ਚਾਹੀਦਾ ਅਤੇ ਕਿਤੇ ਕੱਟਦੇ ਬੂਟਿਆਂ ਨੂੰ ਰੋਕ ਦੇਣਾ ਚਾਹੀਦਾ ਹੈ ਜੇ ਕੋਈ ਬੂਟਾ ਕੱਟੇ ਤਾਂ ਉਸਨੂੰ ਰੋਕਣਾ ਚਾਹੀਦਾ ਹੈ ਕਿ ਉਸਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਹੋਰ ਵੀ ਜ਼ਿਆਦਾ ਬੂਟੇ ਲਗਾਉਣ ਤਾਂ ਜੋ ਸਾਡਾ ਵਾਤਾਵਰਨ ਸ਼ੁੱਧ ਅਤੇ ਸਾਫ਼ ਸੁਥਰਾ ਰਹੇ ਅਤੇ ਸਾਨੂੰ ਕਿਤੇ ਵੀ ਗੰਦ ਨਹੀਂ ਪਾਉਣਾ ਚਾਹੀਦਾ ਅਤੇ ਥਾਂ ਥਾਂ ਡਸਟਬਿਨ ਅਤੇ ਬਹੁਤ ਸਾਰੇ ਡਸਟਬਿਨ ਲਗਾ ਕੇ ਉਹਨਾਂ ਵਿੱਚ ਸਾਰੇ ਕਾਗਜ਼ ਸੁੱਟਣੇ ਚਾਹੀਦੇ ਹਨ ਧੰਨਵਾਦ